ਭਰਾ ਦੀ ਸਿਲਾਈ ਮਸ਼ੀਨ ਕੱਪੜੇ ਦੀ ਸ਼ੋਪ ਹੈ ਜਿਹਦੇ ਕੋਲ ਵੱਖਰੇ ਵੱਖਰੇ ਕੁਆਲਟੀ ਦੇ ਕੱਪੜੇ ਹਨ ਅਤੇ ਲੋਕ ਉਹਨਾਂ ਕੋਲ ਆ ਕੇ ਕੱਪੜੇ ਬਣਵਾਉਂਦੇ ਹਨ ਜਿਵੇਂ ਉਹ ਕੁੜਤਾ ਪਜਾਮਾ ਚਾਦਰਾ ਕੁੜਤਾ ਪਾਕਿਸਤਾਨੀ

ਇਹ ਵੱਖਰੇ ਵੱਖਰੇ ਡਿਜ਼ਾਈਨ ਦੇ ਅਤੇ ਵੱਖਰੀ ਵੱਖਰੇ ਵੱਖਰੇ ਡਿਜ਼ਾਈਨ ਨਾਲ ਬਣਾਉਂਦੇ ਹਨ ਅਤੇ ਇਹ ਸ਼ੋਪ ਸਾਡੀ ਮਾਰਕੀਟ ਵਿੱਚ ਬਹੁਤ ਮਸ਼ਹੂਰ ਹੈ ਅਤੇ ਲੋਕ ਦੂਰੋਂ ਦੂਰੋਂ ਸਿਲਾਈ ਕਰਾਉਣ ਆਉਂਦੇ ਹਨ